ਮੈਂ ਅਸਲ ਵਿੱਚ ਤੁਹਾਡੀ ਕੰਪਨੀ ਤੋਂ ਕ ਕੈਬ ਬੁੱਕ ਕਰਨ ਬਾਰੇ ਪਤਾ ਕਰਨਾ ਸੀ ਮੇਰੀ ਅਤੇ ਮੇਰੇ ਪਰਿਵਾਰ ਦੇ ਜਿਹੜੇ ਲੋਕ ਨੇ ਅਸੀਂ ਪੰਜ ਪਰਿਵਾਰਕ ਮੈਂਬਰ ਹੈਗੇ ਹਾਂ ਦੋ ਬਜ਼ੁਰਗ ਨੇ ਸਾਡੇ ਨਾਲ ਅਤੇ ਦੋ ਅਸੀਂ ਪਤੀ ਪਤਨੀ ਹਾਂ ਨਾਲ ਸਾਡਾ ਬੱਚਾ ਹੈ ਅਸੀਂ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਉੱਤੇ ਜਾਣਾ ਚਾਹੁੰਦੇ ਹਾਂ ਨੇੜੇ ਹੀ ਸਾਡੇ ਇੱਥੇ ਗੁਰਦੁਆਰਾ ਸਾਹਿਬ ਹੈਗੇ ਨੇ ਉਹ ਦੋ ਤਿੰਨ ਸ਼ਹਿਰ ਨੇੜੇ ਨੇੜੇ ਪੈਂਦੇ ਨੇ ਅਤੇ ਅਸੀਂ ਉੱਥੇ ਜਿਹੜਾ ਹੈਗਾ ਜਾ ਕੇ ਇੱਕ ਦਿਨ ਦੇ ਵਿੱਚ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਣਾ ਚਾਹੁੰਦੇ ਹਾਂ ਅਤੇ ਉਹਦੇ ਕਰਕੇ ਮੈਂ ਤੁਹਾਨੂੰ ਛੋਟੀ ਅਤੇ ਵੱਡੀ ਕਾਰ ਦੀਆਂ ਕੀਮਤਾਂ ਦੇ ਵਿੱਚ ਅੰਤਰ ਜਿਹੜਾ ਦੇਖਣਾ ਚਾਹੁੰਦੀ ਹਾਂ ਪੁੱਛਣਾ ਚਾਹੁੰਦੀ ਸੀ ਤਾਂ ਜੋ ਵੀ ਮੈਂ ਉਸ ਹਿਸਾਬ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੀ ਲੋੜ ਅਤੇ ਜਿਹੜਾ ਹੈਗਾ ਆਪਣੀਆਂ ਸੁਵਿਧਾਵਾਂ ਦੇ ਹਿਸਾਬ ਦੇ ਨਾਲ ਡਿਸਾਈਡ ਕਰ ਸਕਾਂ ਵੀ ਕਿ ਕਿਹੜਾ ਅਸੀਂ ਲੈਣਾ ਚਾਹੁੰਦੇ ਹਾਂ ਅਤੇ ਇੱਕ ਤਾਂ ਤੁਸੀਂ ਮੈਨੂੰ ਇਹ ਦੱਸ ਦਿਉ ਜੀ ਵੀ ਜਿਹੜੀ ਛੋਟੀ ਗੱਡੀ ਹੈ ਤੁਹਾਡੇ ਕੋਲ ਛੋਟੀ ਕੈਬ ਉਹਦੇ ਵਿੱਚ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਕਾਰਾਂ ਉਪਲਬਧ ਨੇ ਵੀ ਕੀ ਉਹਦੀ ਜਿਹੜੀ ਹੈਗੀ ਆ ਉਹਦੇ 'ਚ ਕਿਹੜੀਆਂ ਸਹੂਲਤਾਂ ਸਾਨੂੰ ਮਿਲ ਸਕਦੀਆਂ ਨੇ ਅਤੇ ਦੂਸਰਾ ਜੀ ਜਿਹੜੀ ਵੱਡੀ ਕੈਬ ਹੈ ਜਿਹਦੇ ਵਿੱਚ ਜਿਹੜਾ ਹੈਗਾ ਛੇ ਲੋਕ ਨੇ ਜਾਂ ਉਸ ਤੋਂ ਜ਼ਿਆਦਾ ਛੇ ਸੀਟਰ ਜਾਂ ਉਸ ਤੋਂ ਜਿਹੜੀ ਹੁੰਦੀ ਆ ਵੱਡੀ ਕਾਰ ਉਹ ਤੁਹਾਡੇ ਕੋਲ ਕਿਹੜੀਆਂ ਕੰਪਨੀ ਦੀਆਂ ਉਪ ਉਪਲਬਧ ਹੈਗੀਆਂ ਨੇ ਅਤੇ ਉਸ ਹਿਸਾਬ ਦੇ ਨਾਲ ਕਿਉਂਕਿ ਇੱਕ ਤਾਂ ਸਾਡੇ ਜਿਹੜੇ ਹੈਗੇ ਨੇ ਬਜ਼ੁਰਗ ਨੇ ਸਾਡੇ ਨਾਲ ਉਹਨਾਂ ਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਆਰਾਮਦਾਇਕ ਸੀਟਾਂ ਚਾਹੀਦੀਆਂ ਨੇ ਅਤੇ ਉਹਦੇ ਕਰਕੇ ਸਾਨੂੰ ਇਹ ਆ ਵੀ ਜੇ ਉਹਨਾਂ ਨੇ ਕਿਸੇ ਨੇ ਦੂਸਰਾ ਸਾਡੇ ਨਾਲ ਬੱਚਾ ਹੈ ਅਤੇ ਉਹ ਬੱਚੇ ਕਰਕੇ ਸਾਨੂੰ ਇਹ ਆ ਵੀ ਬੱਚੇ ਨੂੰ ਹੁਣ ਕਈ ਵਾਰੀ ਰਸਤੇ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਥੱਕ ਗਏ ਜੀ ਜ਼ਿਆਦਾ ਦੇਰ ਆਪਾਂ ਗੋਦ 'ਚ ਵੀ ਨਹੀਂ ਲਿਟਾ ਸਕਦੇ ਬੱਚੇ ਨੂੰ ਅਤੇ ਇਸ ਕਰਕੇ ਜੇ ਬੱਚਾ ਸੌਂ ਜਾਂਦਾ ਤਾਂ ਆਪਾਂ ਉਹਨੂੰ ਐਨੀ ਕੁ ਸਾਨੂੰ ਮਤਲਬ ਥੋੜ੍ਹੀ ਖੁੱਲੀ ਡੁੱਲੀ ਹੋਵੇ ਇੱਕ ਤਾਂ ਲੱਤਾਂ ਥੋੜ੍ਹੀਆਂ ਜਿਹੀਆਂ ਬਜ਼ੁਰਗਾਂ ਦੀ ਪ੍ਰੋਬਲਮ ਹੈਗੀ ਗੋਡਿਆਂ ਦੀ ਵੀ ਲੱਤਾਂ ਨੂੰ ਸਹੀ ਜਗ੍ਹਾ ਮਿਲ ਜਾਵੇ ਆਰਾਮਦਾਇਕ ਦੂਸਰਾ ਜੇ ਤਾਂ ਸਾਡਾ ਬੱਚਾ ਸੌਂ ਜਾਂਦਾ ਤਾਂ ਅਸੀਂ ਉਹਨੂੰ ਮਤਲਬ ਸਾਡੇ ਕੋਲ ਐਨੀ ਕੁ ਜਗ੍ਹਾ ਹੋਵੇ ਵੀ ਅਸੀਂ ਉਹਨੂੰ ਵਿਚਾਲੇ ਲਿਟਾ ਸਕੀਏ ਅਤੇ ਫੇਰ ਇਹ ਦੂਸਰਾ ਜੀ ਰਸਤਾ ਵੀ ਜਿਵੇਂ ਸਵੇਰ ਤੋਂ ਜਾ ਕੇ ਸ਼ਾਮ ਤੱਕ ਹੈਗਾ ਤਾਂ ਸਾਨੂੰ ਸੀਟਾਂ ਜਿਹੜੀਆਂ ਆਰਾਮਦਾਇਕ ਚਾਹੀਦੀਆਂ ਨੇ ਅਤੇ ਕੀਮਤ ਦੇ ਵਿੱਚ ਕਿੰਨਾ ਕੁ ਅੰਤਰ ਹੋਊਗਾ ਉਸ ਹਿਸਾਬ ਨਾਲ ਫੇਰ ਅਸੀਂ ਦੇਖ ਲਵਾਂਗੇ ਵੀ ਚਾਰ ਲੋਕ ਕਿਹੜੀ ਗੱਡੀ 'ਚ ਆਰਾਮ ਨਾਲ ਬੈਠ ਸਕਦੇ ਨੇ ਅਤੇ ਜੇ ਅਸੀਂ ਪੰਜ ਜਣਿਆਂ ਦੀ ਹੈਗੀ ਸਹੂਲਤ ਸਾਡੇ ਕੋਲ ਉਹਦੇ ਲਈ ਅਸੀਂ ਕਿਹੜੀ ਕਾਰ ਡੀਸਾਈਡ ਕਰੀਏ ਤਾਂ ਜੋ ਸਾਨੂੰ ਸਾਰੀਆਂ ਸਹੂਲਤਾਂ ਵੀ ਸਾਡੀਆਂ ਮਿਲ ਜਾਣ ਅਤੇ ਸਾਨੂੰ ਬਹੁਤ ਜ਼ਿਆਦਾ ਜਿਹੜੀ ਕੀਮਤ ਵੀ ਨਾ ਦੇਣੀ ਪਵੇ ਇਹਦੇ ਲਈ ਅਤੇ ਕਿਰਪਾ ਕਰਕੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਇਹ ਵੇਰਵਾ ਦੇ ਦਿਉ ਤਾਂ ਜੋ ਅਸੀਂ ਆਪਣਾ ਫੈਸਲਾ ਲੈ ਸਕੀਏ